ਅੱਜ ਤੋਂ ਕੋਈ ਵੀਹ ਸਾਲ ਪਹਿਲਾਂ ਮੈਨੂੰ ਇੱਕ ਪੰਜਾਬੀ ਦੇ ਰਾਈਟਰ ਜਿਨ੍ਹਾਂ ਦਾ ਨਾਂ ਅਸ਼ੋਕ ਚੰਨ ਆਲਮਗੀਰ ਹੈ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਸਿਰਫ ਮੌਕਾ ਹੀ ਨਹੀਂ ਮਿਲਿਆ ਸਗੋਂ ਉਹਨਾਂ ਦੀ ਇੱਕ ਕਿਤਾਬ ਜਿਸਦਾ ਨਾਂ ਮਿੱਟੀ ਮਿੱਟੀ ਮਹਾਂ ਕਥਾ ਸੀ ਕੰਪੋਜ ਕਰਨ ਦਾ ਮੌਕਾ ਵੀ ਮਿਲਿਆ ਉਸ ਕਿਤਾਬ ਵਿੱਚ ਆਲਮਗੀਰ ਹੋਰਾਂ ਨੇ ਸਿਫਤੀ ਨਾਂ ਦੀ ਇੱਕ ਲੜਕੀ ਨੂੰ ਕਰੈਕਟਰ ਦੇ ਰੂਪ ਵਿੱਚ ਪੇਸ਼ ਕੀਤਾ ਉਹ ਕਰੈਕਟਰ ਕਾਫੀ ਮਜ਼ੇਦਾਰ ਕਿਹਾ ਜਾ ਸਕਦਾ ਹੈ ਸਿਰਫ ਮਜ਼ੇਦਾਰ ਹੀ ਨਹੀਂ ਸਗੋਂ ਸਿੱਖਿਆ ਦਾਇਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਿਫਤੀ ਨਾਂ ਦੀ ਲੜਕੀ ਜੰਗਲ ਦੇ ਵਿੱਚ ਰਹਿੰਦੀ ਸੀ ਅਤੇ ਉਸਦੇ ਕੁਝ ਜਾਨਵਰ ਸਾਥੀ ਸਨ ਜਿਹਦੇ ਵਿੱਚ ਇੱਕ ਨਾਗ ਇੱਕ ਨਿਓਲਾ ਵੀ ਸ਼ਾਮਿਲ ਸੀ ਕਿਸੇ ਵੀ ਔਕੜ ਦੇ ਵਿੱਚ ਇਹ ਜਾਨਵਰ ਉਸ ਦੀ ਮਦਦ ਕਰਦੇ ਸਨ ਇਸ ਕਰੈਕਟਰ ਤਿਉਂ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਜੇਕਰ ਜਾਨਵਰਾਂ ਦੇ ਨਾਲ ਵੀ ਪਿਆਰ ਪਾਇਆ ਜਾਵੇ ਤਾਂ ਉਹ ਵੀ ਤੁਹਾਡਾ ਸਾਥ ਦੇ ਸਕਦੇ ਹਨ ਅਤੇ ਤੁਹਾਡੇ ਇਸ਼ਾਰਿਆਂ 'ਤੇ ਨੱਚਣ ਲਈ ਮਜ਼ਬੂਰ ਹੋ ਸਕਦੇ ਹਨ ਅਜਿਹੀਆਂ ਅਜਿਹੇ ਪਾਤਰਾਂ ਨੂੰ ਪੜ੍ਹਨ ਦਾ ਮੈਨੂੰ ਹਮੇਸ਼ਾ ਸ਼ੌਕ ਰਹਿੰਦਾ ਹੈ ਜੇ ਕਦੇ ਫੇਰ ਮੌਕਾ ਮਿਲਿਆ ਤਾਂ ਮੈਂ ਅਜਿਹੇ ਕਿਸੇ ਕਰੈਕਟਰ ਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਾਂ